ਮੈਂ ਗੀਤ ਦੀ ਚੋਣ ਆਪਣੀ ਮਾਂ ਬੋਲੀ ਪੰਜਾਬੀ ਨੂੰ ਦੇਖਦੀ ਹੋਈ ਕਰਾਂਗੀ ਕਿਉਂਕਿ ਮੈਂ ਇੱਕ ਪੰਜਾਬੀ ਪਰਿਵਾਰ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧ ਰੱਖਦੀ ਹਾਂ ਮੈਂ ਆਪਣੇ ਆਸ ਪਾਸ ਦੇਖਿਆ ਹੈ ਕਿ ਲੋਕ ਪੰਜਾਬੀ ਗੀਤਾਂ ਨੂੰ ਭੁੱਲ ਕੇ ਭੜਕੀਲੇ ਗਾਣਿਆਂ ਨੂੰ ਸੁਣਨਾ ਪਸੰਦ ਕਰਦੇ ਹਨ ਅਜਿਹੇ ਭੜਕੀਲੇ ਗੀਤ ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਣੇ ਨਹੀਂ ਜਾ ਸਕਦੇ ਮੈਂ ਇਹ ਨਹੀਂ ਚਾਹਾਂਗੀ ਕਿ ਮੈਂ ਆਪਣੇ ਪਰਿਵਾਰ ਵਿੱਚ ਬੈਠ ਕੇ ਅਜਿਹੇ ਗੀਤ ਸੁਣਾ ਜਿਸ ਨਾਲ ਉਹਨਾਂ ਨੂੰ ਵੀ ਸ਼ਰਮਿੰਗਦੀ ਮਹਿਸੂਸ ਹੋਵੇ ਅਤੇ ਮੈਂ ਵੀ ਕਿਤੇ ਨਾ ਕਿਤੇ ਸ਼ਰਮਿੰਦਗੀ ਮਹਿਸੂਸ ਕਰਾਂ ਇਸ ਲਈ ਸਾਨੂੰ ਲੋੜ ਹੈ ਕਿ ਅਸੀਂ ਪੰਜਾਬੀ ਸੱਭਿਆਚਾਰ ਗੀਤਾਂ ਨੂੰ ਰਿਕੋਰਡ ਅਤੇ ਪੇਸ਼ ਕਰੀਏ ਉਹ ਕਹਿੰਦੇ ਹਨ ਕਿ ਇੱਕ ਕਦਮ ਵਧਾਈਏ ਤਾਂ ਅਸੀਂ ਕਿਤੇ ਦੀ ਕਿਤੇ ਪਹੁੰਚ ਸਕਦੇ ਹਾਂ ਇਸ ਲਈ ਮੈਂ ਇਸ ਪੰਜਾਬੀ ਗੀਤ ਨੂੰ ਇੱਕ ਪੰਜਾਬੀ ਗੀਤ ਨੂੰ ਪੇਸ਼ ਅਤੇ ਰਿਕੋਰਡ ਕਰਨਾ ਪਸੰਦ ਕਰਾਂਗੀ ਮੈਨੂੰ ਪੰਜਾਬੀ ਲੋਕ ਗੀਤ ਸੁਣਨੇ ਬਹੁਤ ਪਸੰਦ ਹਨ ਅਤੇ ਮੈਂ ਕਦੇ ਕਦਾਈ ਇਹਨਾਂ ਗੀਤਾਂ ਦਾ ਵੀ ਅਭਿਆਸ ਕਰਦੀ ਹਾਂ ਮੈਂ ਆਪਣੇ ਸੰਗੀਤ ਵਾਲੇ ਟੀਚਰ ਕੋਲੋਂ ਵੀ ਲੋਕ ਗੀਤ ਅਤੇ ਬੋਲੀਆਂ ਵਾਰਾਂ ਦਾ ਅਭਿਆਸ ਕਰਦੀ ਹਾਂ ਧੰਨਵਾਦ